ਖੇਡਾਂ ਖੇਡਣ ਨਾਲ਼ ਸਾਨੂੰ ਕੋਈ ਵੀ ਟੈਂਸ਼ਨ ਨਹੀਂ ਰਹਿੰਦੀ ਖੇਡਾਂ ਖੇਡਣ ਨਾਲ਼ ਸਾਡਾ ਸਰੀਰ ਬਹੁਤ ਹੀ ਤੰਦਰੁਸਤ ਹੋ ਜਾਂਦਾ ਏ ਇਸ ਕਰਕੇ ਖੇਡ ਸਾਨੂੰ ਖੇਡਣੀ ਚਾਹੀਦੀਆਂ ਸਾਨੂੰ ਸ਼ਾਮ ਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਜੋ ਕਿ ਸਾਡਾ ਸਰੀਰ ਵੀ ਵਧੀਆ ਚੱਲਦਾ ਹੈ ਅਤੇ ਸਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਹੈਂ ਜਦ ਵੀ ਅਸੀਂ ਵਿਹਲੇ ਹੁੰਦੇ ਹਾਂ ਤਾਂ ਕੋਈ ਵੀ ਅਸੀਂ ਖੇਡ ਖੇਡਣ ਲੱਗ ਜਾਂਦੇ ਹਾਂ ਜਿਸ ਕਰਕੇ ਸਾਡਾ ਵੀ ਟਾਇਮ ਪਾਸ ਹੋ ਜਾਂਦਾ ਹੈ ਗੇਮਾਂ ਵਧੀਆ ਅਸੀਂ ਖੇਡ ਲੈਂਦੇ ਹਾਂ ਅਤੇ ਅਸੀਂ ਜਦ ਕਿ ਰਾਤ ਨੂੰ ਵੀ ਜਾ ਕੇ ਅਸੀਂ ਘਰੇ ਟੀ ਵੀ ਚਲਾ ਕੇ ਕ੍ਰਿਕਟ ਦਾ ਮ ਮੈਚ ਦੇਖਦੇ ਹਾਂ ਜੋ ਕਿ ਬਹੁਤ ਹੀ ਵਧੀਆ ਲੱਗਦਾ ਹੈ ਅਸ ਉਸ ਮੈਚ ਵਿੱਚ ਅਸੀਂ ਆਨੰਦ ਮਾਣਦੇ ਹਾਂ ਖੇਡਾਂ ਇੱਕ ਇਦ ਇਸ ਏਦਾ ਦਾ ਸਾਧਨ ਹੈ ਜੋ ਕਿ ਹਰੇਕ ਵਿਅਕਤੀ ਨੂੰ ਖੇਡਣਾ ਚਾਹੀਦਾ ਹੈ ਅਤੇ ਆਪਣੀ ਤੰਦਰੁਸਤੀ ਦਿਮਾਗੀ ਤੌਰ 'ਤੇ ਵੀ ਬਹੁਤ ਹੀ ਵਧੀਆ ਖੇਡ ਹੈ ਇਸ ਕਰਕੇ ਖੇਡਾਂ ਖੇਡਣ ਨਾਲ਼ ਬਹੁਤ ਹੀ ਸਾਨੂੰ ਲਾਭਦਾਇਕ ਹੁੰਦਾ ਏ ਸਾਨੂੰ ਹਮੇਸ਼ਾ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਜੋ ਕਿ ਸਰੀਰ ਲਈ ਵਧੀਆ ਹਨ ਬਹੁਤ ਹੀ ਖੇਡਾਂ ਖੇਡਣੀਆਂ ਚਾਹੀਦੀਆਂ ਜੋ ਕਿ ਖੇਡਾਂ ਖੇਡਣ ਨਾਲ਼ ਬਹੁਤ ਹੀ ਸਾਰਾ ਰੋਗਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਖੇਡਾਂ ਬਹੁਤ ਹੀ ਵਧੀਆ ਲੱਗਦੀਆਂ ਹਨ ਖੇਡਾਂ ਇੱਕ ਬਹੁਤ ਹੀ ਵਧੀਆ ਮਨੋਰੰਜਨ ਹੈ ਜੋ ਕਿ ਹਰੇਕ ਵਿਅਕਤੀ ਨੂੰ ਖੇਡਣੀਆਂ ਚਾਹੀਦੀਆਂ ਹਨ